ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹਨ ਅਤੇ ਕੁਝ ਖੁੱਲ੍ਹੇ ਭਾਂਡਿਆਂ ਵਿੱਚ ਪਕਾਏ ਹੋਏ ਭੋਜਨ ਨੂੰ ਤਰਜੀਹ ਦਿੰਦੇ ਹਨ ਤਿਆਰੀ ਅਤੇ ਜਾਂ ਸਵਾਦ ਇਹਨਾਂ ਦਾ ਵੱਖਰਾ ਇਸ ਲਈ ਹੁੰਦਾ ਹੈ ਜਿਹਨਾਂ ਨੂੰ ਜ਼ਿਆਦਾ ਕਾਹਲੀ ਹੁੰਦੀ ਹੈ ਉਹ ਕੁੱਕਰ ਨੂੰ ਤਰਜੀਹ ਦਿੰਦੇ ਹਨ ਕੁੱਕਰ ਦੇ ਵਿੱਚ ਭੋਜਨ ਚੰਗੀ ਤਰ੍ਹਾਂ ਪੱਕਦਾ ਨਹੀਂ ਸਗੋਂ ਗਲ ਜਾਂਦਾ ਹੈ ਭਾਫ ਦੇ ਨਾਲ ਅਤੇ ਜਿਹਨਾਂ ਦੇ ਰੁਝੇਵੇਂ ਭਰਿਆਂ ਦੇ ਵਿੱਚ ਇਹ ਕੁਕਰ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਜਦੋਂ ਕਿ ਦੂਸਰੇ ਪਾਸੇ ਖੁੱਲ੍ਹੇ ਬਰਤਨ ਖੁੱਲ੍ਹੇ ਬਰਤਨ ਦੇ ਵਿੱਚ ਭੋਜਨ ਪੱਕਣ ਨੂੰ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਥੋੜ੍ਹਾ ਜ਼ਿਆਦਾ ਟਾਈਮ ਲੱਗਦਾ ਹੈ ਪਰ ਉਸ ਦੇ ਵਿੱਚ ਪੱਕਿਆ ਹੋਇਆ ਭੋਜਨ ਸਵਾਦ ਹੁੰਦਾ ਹੈ ਅਤੇ ਹੌਲੀ ਹੌਲੀ ਪੱਕਦਾ ਹੈ ਜਦਕਿ ਕੂਕਰ ਦੇ ਵਿੱਚ ਜਲਦੀ ਪੱਕ ਜਾਂਦਾ ਹੈ ਅਤੇ ਰੁਝੇਵੇਂ ਭਰੀ ਜ਼ਿੰਦਗੀਆਂ ਦੇ ਵਿੱਚ ਜ਼ਿਆਦਾਤਰ ਕੂਕਰ ਨੂੰ ਤਰਜੀਹ ਦਿੰਦੇ ਹਨ ਪਰ ਜੋ ਇਹ ਹੈ ਇਹ ਪੱਕਦਾ ਨਹੀਂ ਗਲਦਾ ਹੈ ਅਤੇ ਜੋ ਖੁੱਲ੍ਹੇ ਭਾਂਡਿਆਂ ਦੇ ਵਿੱਚ ਹੈ ਉਹ ਪੱਕਦਾ ਹੈ